ਭਾਅ ਜੀ ਸਤਿ ਸ਼੍ਰੀ ਅਕਾਲ ਜੀ ਬਵੇਜਾ ਮੋਬਾਇਲ ਸ਼ੋਪ ਤੋਂ ਗੱਲ ਕਰ ਰਹੇ ਹੋ ਜੀ ਮੈਂ ਤੁਹਾਡੇ ਤੋਂ ਇੱਕ ਫੋਨ ਔਡਰ ਕੀਤਾ ਸੀਗਾ ਜਿਹਦੀ ਡਿਲੀਵਰੀ ਮੈਨੂੰ ਟਾਈਮ 'ਤੇ ਮਿਲੀ ਹੈ ਜੀ ਮੈਂ ਬਹੁਤ ਸੈਟਿਸਫਾਈਡ ਹਾਂ ਤੁਹਾਡੀ ਸਰਵਿਸ ਤੋਂ ਫੋਨ ਦੇ ਰਿਗਾਰਡਿੰਗ ਅਗਰ ਗੱਲ ਕਰੀਏ ਤਾਂ ਫੋਨ ਦੀ ਜਿਹੜੀ ਬੈਟਰੀ ਬੈਕਅਪ ਹੈ ਬਹੁਤ ਅੱਛਾ ਹੈ ਔਰ ਸਕਰੀਨ ਕੈਮਰਾ ਬਹੁਤ ਅੱਛਾ ਹੈ ਅਗਰ ਵੀਡੀਓਜ਼ ਵਗੈਰਾ ਦੇਖਣ ਲੱਗਦੇ ਹੋ ਤਾਂ ਮਨ ਸੈਟਿਸਫਾਈਡ ਹੁੰਦਾ ਫੋਟੋਜ਼ ਵਗੈਰਾ ਕਲਿੱਕ ਕਰਦੇ ਬਹੁਤ ਅੱਛੀ ਜ ਫੋਟੋਜ਼ ਆਉਂਦੀਆਂ ਇਹ ਫੋਨ ਮੈਂ ਤੁਹਾਡੇ ਤੋਂ ਡਾਊਨ ਪੇਮੈਂਟ 'ਤੇ ਲਿਆ ਸੀਗਾ ਜਿਹਦੀਆਂ ਬਾਕੀ ਮੈਂ ਕਿਸ਼ਤਾਂ ਕੀਤੀਆਂ ਸੀ ਤੁਸੀਂ ਉੱਥੇ ਵੀ ਸਾਡੇ ਨਾਲ ਮੈਨੇਜ ਕੀਤਾ ਸਰ ਥੈਂਕ ਯੂ ਸੋ ਮੱਚ ਤੁਹਾਡੀ ਸਰਵਿਸ ਨੂੰ ਲੈ ਕੇ ਫੋਨ ਦੇ ਰਿਗਾਰਡਿੰਗ ਸਾਨੂੰ ਕੋਈ ਕੰਪਲੇਂਟ ਨਹੀਂ ਹੈ ਫੋਨ ਨੂੰ ਲੈ ਕੇ ਅਸੀਂ ਬਹੁਤ ਸੈਟਿਸਫਾਈਡ ਔਰ ਤੁਹਾਡੀ ਸਰਵਿਸ ਨੂੰ ਲੈ ਕੇ ਬਹੁਤ ਸੈਟਿਸਫਾਈਡ ਹਾਂ ਥੈਂਕ ਯੂ ਸਰ ਥੈਂਕ ਯੂ ਸੋ ਮਚ